ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੇ ਨਾਲ ਫਲਦਾਇਕ ਕੱਪੜੇ ਦੀ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਜੋ ਕਿ ਮੈਂ ਸਿਲਕ ਦਾ ਕੱਪੜਾ ਲਿਆ ਕੇ ਇੱਕ ਸੀਤਾ ਸੀ ਜੋ ਕਿ ਮੈਨੂੰ ਬਹੁਤ ਪਸੰਦ ਹੈ ਤੁਹਾਨੂੰ ਵੀ ਤਾਂ ਪਤਾ ਹੈ ਕਿ ਅੱਜ ਕੱਲ੍ਹ ਵਿਆਹ ਸ਼ਾਦੀਆਂ 'ਤੇ ਸਿਲਕ ਦੇ ਕੱਪੜੇ ਦਾ ਬੜਾ ਹੀ ਰਿਵਾਜ਼ ਹੈ ਅਤੇ ਲੋਕ ਉਸਨੂੰ ਬਹੁਤ ਹੀ ਪ੍ਰਸੰਨ ਹੋ ਕੇ ਪਾਉਂਦੇ ਨੇ ਮੈਂ ਇੱਕ ਸਿਲਕ ਦਾ ਕੱਪੜਾ ਲਿਆਂਦਾ ਜਿਹਦੇ 'ਤੇ ਮੈਂ ਆਪਣੀ ਇੱਕ ਫਰੋ ਫਰੋਕ ਸੀਤੀ ਮੈਂ ਉਸਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੀ ਸੀ ਮੈਂ ਯੂਟੀਊਬ 'ਤੇ ਵੀ ਉਸ ਨ ਦੇ ਬਾਰੇ ਲਿੰਕ ਕੱਢ ਕੇ ਉਸਨੂੰ ਆਪਣੇ ਵੱਲੋਂ ਬਹੁਤ ਹੀ ਸਜਾਣ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸ 'ਤੇ ਕਲੀਆਂ ਲਗਾਈਆਂ ਕਲੀਆਂ ਵਾਲੀ ਫਰੋਕ ਬਣਾਈ ਮੈਂ ਉਸ 'ਤੇ ਲੈਸਾ ਵੀ ਲਗਾਈਆ ਮੈਂ ਉਸਦੇ ਗਲੇ ਦਾ ਬਹੁਤ ਹੀ ਸੋਹਣਾ ਡਿਜ਼ਾਇਨ ਬਣਾਇਆ ਮੈਂ ਉਸਦੀ ਫੁੱਲ ਵਾਲੀ ਬਾਂਹ ਬਣਾਈ ਜਿਹਦੇ ਉੱਤੇ ਕਿ ਮੈਂ ਬਟਨ ਵੀ ਲਗਾਏ ਅਤੇ ਲੈਸਾ ਵੀ ਲਗਾਈਆਂ ਲੈਸਾ ਦੇ ਨਾਲ ਮੈਂ ਤਾਂ ਉਸਨੂੰ ਇੰਨਾ ਕੁ ਸੋਹਣਾ ਬਣਾਇਆ ਸੀ ਕਿ ਉਹ ਤਾਂ ਦੇਖਣ 'ਚ ਵੀ ਹੱਥ ਦਾ ਬਣਿਆ ਹੋਇਆ ਨਹੀਂ ਸੀ ਲੱਗਦਾ ਸੀ ਅਤੇ ਰਹੀ ਗੱਲ ਆ ਗਈ ਪਜਾਮੇ ਦੀ ਪਜਾਮਾ ਮੈਨੂੰ ਬਣਾਉਣਾ ਬਹੁਤ ਹੀ ਥੋੜ੍ਹਾ ਔਖਾ ਲੱਗਦਾ ਸੀ ਕਿਉਂਕਿ ਮੈਂ ਤਾਂ ਜ਼ਿਆਦਾਤਰ ਸਲਵਾਰ ਹੀ ਪਾਉਂਦੀ ਹਾਂ ਇਸ ਲਈ ਮੈਂ ਪਜਾਮਾ ਕਦੇ ਪਾਇਆ ਹੀ ਨਹੀਂ ਅਤੇ ਇਸ ਲਈ ਮੈਨੂੰ ਪਜਾਮਾ ਬਣਾਉਣਾ ਥੋੜ੍ਹਾ ਔਖਾ ਲੱਗਦਾ ਸੀ ਪਰ ਮੇਰੇ ਪਾਪਾ ਵੀ ਜੈਂਟਸ ਕਪ ਕੱਪੜੇ ਬਣਾਉਂਦੇ ਨੇ ਤਾਂ ਉਹਨਾਂ ਦੀ ਮੈਂ ਮਦਦ ਨਾਲ ਅਤੇ ਕੁਛ ਮੈਂ ਯੂਟੀਊਬ ਦੀ ਸਹਾਇਤਾ ਨਾਲ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹਦੇ 'ਤੇ ਕਿ ਮੈਂ ਇੱਕ ਜੇਬ ਵੀ ਲਗਾਈ ਪਰ ਮੈਨੂੰ ਬਣਾਉਣ ਵਿੱਚ ਬਹੁਤ ਹੀ ਔਖਾ ਲੱਗਿਆ ਪਰ ਫਿਰ ਵੀ ਮੈਂ ਉਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਕਿ ਮੈਂ ਉਸ ਨੂੰ ਉਸ ਦੇ ਉੱਪਰ ਇੱਕ ਜੇਬ ਵੀ ਲਗਾਈ ਪਰ ਮੈਂ ਜਦੋਂ ਉਸ ਨੂੰ ਪਾ ਕੇ ਵਿਆਹ 'ਤੇ ਗਈ ਤਾਂ ਮੈਨੂੰ ਸਾਰਿਆਂ ਨੇ ਬਹੁਤ ਹੀ ਸੋਹਣਾ ਸੂਟ ਕਿਹਾ ਮੈਨੂੰ ਮੇਰਾ ਜਿਹਦੇ ਨਾਲ ਕਿ ਮੇਰਾ ਵੀ ਮਨ ਬਹੁਤ ਖੁਸ਼ ਹੋਇਆ ਕਿ ਮੈਂ ਅਕਸਰ ਇੱਕ ਚੀਜ਼ ਬਣਾਈ ਸਿਲਕ ਦਾ ਸੂਟ ਬਣਾਇਆ ਅਤੇ ਮੇਰਾ ਮੇਰੇ ਪ੍ਰੋਹਣਿਆਂ ਨੇ ਵੀ ਮੇਰੇ ਸੂਟ ਨੂੰ ਬਹੁਤ ਪਸੰਦ ਕੀਤਾ ਮੈਨੂੰ ਆਪਣਾ ਉਸ ਸੂਟ ਬਣਾਉਣ 'ਤੇ ਮਾਣ ਸੀ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਆਪਣਾ ਸੂਟ ਬਣਾਉਣਾ ਧੰਨਵਾਦ ਜੀ